ਸਭ ਤੋਂ ਜ਼ਿਆਦਾ ਸਵੈਟਰਾਂ ਅਤੇ ਜੈਕਟਾਂ ਬਣਾਈਆ ਹਨ ਸਿਲਾਈ ਬੁ ਬਣਾਈਆਂ ਹਨ ਸਿਲਾਈ ਕਰਦੀਆਂ ਹਨ ਮੈਨੂੰ ਪੰਜਾਬੀ ਸੂਟ ਬਣਾਉਣਾ ਬਹੁਤ ਪਸੰਦ ਹੈ ਪਰ ਸਭ ਤੋਂ ਵੱਧ ਅੱਜ ਕੱਲ੍ਹ ਪੰਜਾਬੀ ਸੱਭਿਆਚਾਰ ਅਕੋਡਿੰਗ ਪੰਜਾਬੀ ਸੂਟਾਂ ਦੇ ਨਾਲ ਨਾਲ ਵੈਸਟਰਨ ਪਹਿਰਾਵਾ ਵੀ ਬਹੁਤ ਜ਼ਿਆਦਾ ਵੱਧ ਰਿਹਾ ਹੈ ਜੋ ਤੁਸੀਂ ਤੇਜ਼ੀ ਨਾਲ ਬਿਹਤਰ ਕੰਮ ਕਰਨ ਲਈ ਲਾਗੂ ਕਰਦੇ ਹੋ ਤੇਜ਼ੀ ਨਾਲ ਕੰਮ ਕਰਨ ਲਈ ਸਭ ਤੋਂ ਜ਼ਿਆਦਾ ਆਪ ਆਪਣਾ ਮਨ ਇਕਾਗਰ ਹੋਣਾ ਚਾਹੀਦਾ ਹੈ ਇੱਕ ਜਗ੍ਹਾ 'ਤੇ ਟਿਕਿਆ ਹੋਣਾ ਚਾਹੀਦਾ ਹੈ ਤਾਂ ਜੋ ਆਪਾਂ ਤੇਜ਼ੀ ਨਾਲ ਕੰਮ ਕਰ ਸਕੀਏ